ਹੈਲੋ ਸਤਿ ਸ਼੍ਰੀ ਅਕਾਲ ਭੈਣ ਜੀ ਕੀ ਹਾਲ ਆ ਜੀ ਵਧੀਆ ਕਦੇ ਆ ਹੀ ਜਾਇਆ ਕਰੋ ਹਾਂਜੀ ਓਹ ਤਾਂ ਹੈਗਾ ਕਿੰਨੀ ਭੀੜ ਸੀ ਹਾਂਜੀ ਹਾਂਜੀ

ਜਦੋਂ ਜਾਂਦੇ ਹੁੰਦੇ ਸੀ ਉਦੋਂ ਵੀ ਅਸੀਂ ਪੈਦਲ ਤੁਰ ਕੇ ਆ ਜਾਈਦਾ ਹੁੰਦਾ ਸੀ ਉਦੋਂ ਕੋਈ ਇੰਨੀ ਟ੍ਰੈਫਿਕ ਨਹੀਂ ਸੀ ਹੁੰਦੀ ਹਾਂਜੀ ਹਾਂਜੀ

ਕੋਲਜ ਜਾਂਦਾ ਹਾਂ ਅਤੇ ਕੋਲਜ ਵੱਲ ਵੀ ਕਿੰਨੇ ਹੀ ਆਟੋ ਹੁੰਦੇ ਆ ਜਾਂ ਟ੍ਰੈਫਿਕ ਹੁੰਦੀ ਆ ਜਾਂ ਮੋਟਰਸਾਈਕਲ ਸਾਰਾ ਹੀ ਹਾਂਜੀ ਜੀ ਹਾਂਜੀ ਕਿੰਨਾ ਹੀ ਟਾਈਮ ਲੱਗ ਜਾਂਦਾ ਟ੍ਰੈਫਿਕ ਤੋਂ ਬਾਹਰ ਨਿਕਲਦੇ ਨੂੰ ਹਾਂਜੀ ਹਾਂਜੀ ਹੁਣ ਨਾਲ ਥੋੜ੍ਹੇ ਐਕਸੀਡੈਂਟ ਵੀ ਵੱਧ ਗਏ ਆ ਹਾਂਜੀ ਟ੍ਰੈਫਿਕ ਨੂੰ

ਪਿੰਡਾਂ ਵੱਲ ਤਾਂ ਇੰਨੀ ਟ੍ਰੈਫਿਕ ਨਹੀਂ ਹੁੰਦੀ ਜਿੰਨੀਆਂ ਸ਼ਹਿਰਾਂ ਵਿੱਚ ਹੁੰਦੀ ਹੈ ਟ੍ਰੈਫਿਕ ਇੱਕ ਚਾਰ ਚਾਰ ਮੋਟਰਸਾਈਕਲ ਰੱਖੇ ਹੁੰਦੇ ਇੱਕ ਘਰ 'ਚ ਹਮ ਚਲੋ ਜੀ ਠੀਕ ਆ ਆਊਂ ਠੀਕ ਓਕੇ